ਕੁਛ ਦਿਨ ਪਹਿਲਾਂ ਮੈਂ ਮਤਲਬ ਔਨਲਾਈਨ ਜਿਹੜੇ ਨੇ ਪਲਾਸਟਿਕ ਦੇ ਕੰਟੇਨਰ ਮੰਗਵਾਏ ਸੀ ਫਲਿੱਪਕਾਰਟ ਤੋਂ ਉਨ੍ਹਾਂ ਦੇ ਸੰਬੰਧੀ ਜਿਹੜਾ ਮੇਰਾ ਤਜ਼ਰਬਾ ਹੈ ਉਹ ਬਹੁਤ ਬੁਰਾ ਰਿਹਾ ਕਿਉਂਕਿ ਪਹਿਲਾਂ ਤਾਂ ਜਦੋਂ ਡਿਲੀਵਰੀ ਵਾਲਾ ਡਿਲੀਵਰੀ ਕਰਨ ਆਇਆ ਮੈਂ ਦੇਖਿਆ ਪੈਕਿੰਗ ਜਿਹੜੀ ਸੀਗੀ ਉਹ ਬਾਹਰੋਂ ਠੀਕ ਨਹੀਂ ਸੀ ਉਹ ਜਿਵੇਂ ਫਟੀ ਹੋਈ ਸੀ ਕਿਸ ਤਰ੍ਹਾਂ ਫਿਰ ਮੈਨੂੰ ਲੱਗਿਆ ਚਲੋ ਕੋਈ ਗੱਲ ਨਹੀਂ ਪਰ ਜਦੋਂ ਮੈਂ ਉਹ ਖੋਲ੍ਹ ਕੇ ਵੇਖੇ ਜਿਹੜੇ ਪਲਾਸਟਿਕ ਦੇ ਕੰਟੇਨਰ ਮੈਂ ਮੰਗਵਾਏ ਸੀ ਤਾਂ ਉਹ ਪਹਿਲੀ ਗੱਲ ਤਾਂ ਜਿਹੜਾ ਰੰਗ ਮੈਂ ਮੰਗਵਾਇਆ ਸੀ ਉਹ ਰੰਗ ਹੀ ਨਹੀਂ ਸੀ ਹੈਗਾ ਦੂਸਰਾ ਉਹਨਾਂ ਦੇ ਵਿੱਚੋਂ ਇੱਕ ਕੰਟੇਨਰ ਦਾ ਉੱਪਰ ਢੱਕਣ ਨਹੀਂ ਸੀ ਹੈਗਾ ਤਾਂ ਮੇਰਾ ਮਨ ਬੜਾ ਖਰਾਬ ਹੋਇਆ ਮਤਲਬ ਜਿਸ ਖੁਸ਼ੀ ਦੇ ਨਾਲ ਜੋ ਮਤਲਬ ਮੈਂ ਸੋਚ ਕੇ ਮੰਗਵਾਏ ਸੀ ਉਹ ਚੀਜ਼ ਤਾਂ ਨਿਕਲੀ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਸੋਚਿਆ ਵੀ ਚਲੋ ਵਰਤਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਨੂੰ ਧੋ ਲੈਂਦੇ ਹਾਂ ਤਾਂ ਜਦੋਂ ਮੈਂ ਉਸ ਨੂੰ ਟੂਟੀ ਅੱਗੇ ਕੀਤਾ ਤਾਂ ਉਹਦੇ 'ਚੋਂ ਪਾਣੀ ਵੀ ਲੀਕ ਹੋ ਰਿਹਾ ਸੀ ਮਤਲਬ ਇੱਕ ਨੂੰ ਤਰੇੜ ਆਈ ਹੋਈ ਸੀ ਤਾਂ ਇਹ ਜਿਹੜਾ ਐਕਸਪੀਰੀਅੰਸ ਹੈ ਬਹੁਤ ਖਰਾਬ ਸੀ ਮੈਂ ਮਤਲਬ ਬੜੀ ਖੁਸ਼ੀ ਦੇ ਨਾਲ ਮੰਗਵਾਏ ਸੀ ਮੈਨੂੰ ਮੇਰੀ ਕਿਸੇ ਸਹੇਲੀ ਨੇ ਕਿਹਾ ਵੀ ਸੀ ਕਿ ਔਨਲਾਈਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤੀਆਂ ਵਧੀਆਂ ਨਹੀਂ ਨਿਕਲਦੀਆਂ ਹੁੰਦੀਆਂ ਬਾਜ਼ਾਰ 'ਚੋਂ ਘੁੰਮ ਫਿਰ ਕੇ ਲੈਣੀਆਂ ਚਾਹੀਦੀਆਂ ਨੇ ਪਰ ਮੈਂ ਉਹਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਜਦੋਂ ਕਿ ਜਿਹੜਾ ਬਜ਼ਾਰ ਦੇ ਵਿੱਚੋਂ ਜਦੋਂ ਮੈਂ ਆਪਣੀ ਸਹੇਲੀ ਨੂੰ ਵਿਖਾਏ ਉਹ ਕਹਿੰਦੀ ਇਹ ਸੈੱਟ ਤਾਂ ਪੰਜ ਸੌ ਦਾ ਮਿਲਦਾ ਅਤੇ ਔਨਲਾਈਨ ਮੈਨੂੰ ਇਹ ਸੱਤ ਸੌ ਦਾ ਪਿਆ ਔਰ ਮਹਿੰਗਾ ਵੀ ਪਿਆ ਔਰ ਜੋ ਸੋਚ ਕੇ ਮੰਗਵਾਏ ਸੀ ਉਹ ਚੀਜ਼ ਵੀ ਨਹੀਂ ਨਿਕਲੀ ਅਤੇ ਇਸ ਤਰ੍ਹਾਂ ਔਨਲਾਈਨ ਮੰਗਵਾਉਣ ਦਾ ਮੇਰਾ ਤਜ਼ਰਬਾ ਜਿਹੜਾ ਉਹ ਬਹੁਤ ਬੁਰਾ ਰਿਹਾ ਮੇਰਾ ਮਨ ਬਹੁਤ ਖਰਾਬ ਹੋਇਆ